ਵਿਆਹ ਵਰਗੇ ਵੱਡੇ ਸਮਾਰੋਹਾਂ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਕਰਨ ਲਈ ਵਿਆਹ ਵਾਲੇ ਘਰ ਦੇ ਮੈਂਬਰਾਂ ਦਾ ਅਨੁਮਾਨ ਲਾਉਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਕਿੰਨੇ ਜਣੇ ਹਨ ਅਤੇ ਕਿੰਨਿਆਂ ਨੇ ਹੋਰ ਆਉਣਾ ਹੈ ਇਸ ਦੀ ਅੰਦਾਜ਼ਨ ਗਿਣਤੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਪੀਣ ਵਾਲਾ ਪਾਣੀ ਅਤੇ ਹੋਰ ਵਰਤੋਂ ਵਿੱਚ ਲਿਆਉਂਦੇ ਜਾਣ ਵਾਲਾ ਪਾਣੀ ਜਿਵੇਂ ਕਿ ਨਹਾਉਣਾ ਭਾਂਡੇ ਸਾਫ ਕਰਨਾ ਆਦਿ ਨੂੰ ਅੱਡ ਅੱਡ ਸਟੋਰ ਕਰਨਾ ਚਾਹੀਦਾ ਹੈ ਅਲੱਗ ਅਲੱਗ ਸਟੋਰ ਕਰਨਾ ਚਾਹੀਦਾ ਹੈ ਸਟੋਰ ਕਰਨ ਲਈ ਘੱਟ ਤੋਂ ਘੱਟ ਦੋ ਹਜ਼ਾਰ ਲੀਟਰ ਦੇ ਪਾਣੀ ਵਾਲਾ ਟੈਂਕ ਹੋਣਾ ਚਾਹੀਦਾ ਹੈ ਪੀਣ ਵਾਲਾ ਪਾਣੀ ਆਰ ਓ ਤੋਂ ਜਾਂ ਜੋ ਸੰਸਥਾਵਾਂ ਜੋ ਪਾਣੀ ਸਪਲਾਈ ਕਰਦੀਆਂ ਹਨ ਤੋਂ ਮੰਗਵਾਇਆ ਜਾ ਸਕਦਾ ਹੈ ਨਹਾਉਣ ਅਤੇ ਭਾਂਡਿਆਂ ਲਈ ਵਰਤਿਆ ਜਾਣ ਵਾਲਾ ਪਾਣੀ ਕੱਸੀਆਂ ਨਹਿਰਾਂ ਤੋਂ ਲਿਆਂਦਾ ਜਾ ਸਕਦਾ ਹੈ ਇਸ ਵਿੱਚ ਇੱਕ ਮਹੱਤਵਪੂਰਨ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਪਾਣੀ ਦੀ ਦੁਰਵਰਤੋਂ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਪਾਣੀ ਦੀ ਸਹੀ ਵਰਤੋਂ ਹੋਣੀ ਚਾਹੀਦੀ ਹੈ ਕਿਉਂਕਿ ਅਸਲ ਵਿੱਚ ਜਲ ਹੀ ਜੀਵਨ ਹੈ